ਮੈਂ ਸੁਖਵੰਤ ਸਿੰਘ ਅਤੇ ਮੈਂ ਆਪਣੇ ਪਰਿਵਾਰ ਬਾਰੇ ਗੱਲ ਕਰਾਂ ਤਾਂ ਮੇਰੇ ਅਸੀਂ ਦੋ ਭਰਾ ਹਾਂ ਅਤੇ ਇੱਕ ਮੇਰੀ ਭੈਣ ਹੈ ਚਾਚੇ ਤਾਏ ਬਹੁਤ ਹਨ ਸਾਰਾ ਪਰਿਵਾਰ ਸਾਡਾ ਠੀਕ ਹੈ ਮੇਰੇ ਪਿਤਾ ਜੀ ਇੱਕ ਕਿਸਾਨ ਸਨ ਅਤੇ ਮਾਤਾ ਜੀ ਘਰੇਲੂ ਔਰਤ ਸਨ ਮੇਰਾ ਇੱਕ ਭਰਾ ਸੀ ਜਿਹੜਾ ਬੈਂਕ ਵਿੱਚ ਜੋਬ ਕਰਦਾ ਸੀ ਮੇਰੀ ਇੱਕ ਸਿਸਟਰ ਹੈ ਭੈਣ ਹੈ ਉਹਦਾ ਵਿਆਹ ਹੋ ਚੁੱਕਿਆ ਹੋਇਆ ਅਤੇ ਉਹ ਵੀ ਆਪਣੇ ਘਰ ਠੀਕ ਠਾਕ ਰਹਿੰਦੀ ਹੈ ਬਾਕੀ ਮੇਰੇ ਮਿੱਤਰ ਬਹੁਤ ਹਨ ਬਚਪਨ ਦੇ ਦੋਸਤ ਮੇਰੇ ਕਈ ਵਿੱਚ ਹੁਣ ਵੀ ਮੇਰੇ ਨਾਲ ਉਸ ਤਰ੍ਹਾਂ ਵਰਤਦੇ ਹਨ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਵਰਤਦੇ ਰਹੇ ਹੈ ਬਾਕੀ ਮੇਰੇ ਨੌਕਰੀ ਦੌਰਾਨ ਵੀ ਮੇਰੇ ਬਹੁਤ ਦੋਸਤ ਬਣੇ ਜਿਹੜਾ ਵੀ ਮੇਰਾ ਦੋਸਤ ਬਣਿਆ ਅੱਜ ਤੱਕ ਕਦੇ ਮੈਨੂੰ ਛੱਡ ਕੇ ਨਹੀਂ ਗਿਆ ਹਮੇਸ਼ਾ ਵਧੀਆ ਦੋਸਤ ਬਣੇ ਨੇ ਬਾਹਰ ਅੰਦਰ ਚੰਗੇ ਕੰਮ ਕਰਦੇ ਨੇ ਕਈ ਮੇਰੇ ਦੋਸਤ ਵਿਦੇਸ਼ਾਂ ਵਿੱਚ ਵੀ ਰਹਿੰਦੇ ਨੇ ਜਿਨ੍ਹਾਂ ਦਾ ਬਹੁਤ ਵਧੀਆ ਆਪਣੇ ਆਪਣਾ ਕਾਰੋਬਾਰ ਹੈ ਅਤੇ ਉਹ ਬੜੀ ਕਾਮਯਾਬੀ ਦੇ ਸਿਖਰਾਂ ਛੂਹ ਰਹੇ ਹਨ ਜਿਹੜੇ ਇੱਥੇ ਵੀ ਨੇ ਉਹ ਵੀ ਕਈ ਐਗਰੀਕਲਚਰ ਦਾ ਕੰਮ ਕਰਦੇ ਖੇਤੀਬਾੜੀ ਕਰਦੇ ਹਨ ਉਹ ਵੀ ਬੜਾ ਸੋਹਣਾ ਉਹਨਾਂ ਦਾ ਕੰਮ ਹੈ ਅਤੇ ਕਈ ਮੁਸੀਬਤਾਂ ਵੀ ਵਿੱਚ ਚਲੋ ਆਉਂਦੀਆਂ ਹਨ ਦੋਸਤੀ ਦੇ ਪਰ ਸਹੀ ਢੰਗ ਨਾਲ ਉਹਨਾਂ ਨੂੰ ਜੇ ਆਪਾਂ ਸਹੀ ਢੰਗ ਨਾਲ ਨਜਿੱਠਿਆ ਜਾਵੇ ਤਾਂ ਆਪਣੀ ਦੋਸਤੀ ਬਣੀ ਰਹਿੰਦੀ ਹੈ ਦੋਸਤੀ ਵਿੱਚ ਕਦੇ ਵੀ ਕੋਈ ਗੱਲ ਉਹਲੇ ਵਾਲੀ ਨਹੀਂ ਰੱਖਣੀ ਚਾਹੀਦੀ ਸਦਾ ਇੱਕ ਦੂਜੇ ਦੋਸਤ ਦੇ ਕੰਮ ਆਉਣਾ ਚਾਹੀਦਾ ਹੈ